ਹਮ ਇਹ ਕੋਸ਼ਨ ਦਾ ਆਂਸਰ ਮੈਨੂੰ ਬਖੂਬੀ ਆਉਂਦਾ ਸਾਡੇ ਪਿੰਡ ਵਿੱਚ ਹਾਂ ਭਜਨ ਮੰਡਲੀ ਹੈਗੀ ਹੈ ਉਹ ਸਾਡੇ ਪਿੰਡ ਲਾਗੇ ਇੱਕ ਮੰਦਰ ਹੈ ਵੈਸੇ ਮੰਦਰ ਤਾਂ ਸਾਡੇ ਪਿੰਡ ਬਹੁਤ ਨੇ ਪਰ ਜਿਹੜਾ ਸੜਕ 'ਤੇ ਮੰਦਰ ਹੈ ਪਿੱਪਲ ਦੇ ਥੱਲੇ ਉਹ ਇੱਕ ਮਾਤਾ ਦਾ ਮੰਦਰ ਹੈ ਅਤੇ ਉੱਥੇ ਮਤਲਬ ਕਿ ਹਰ ਦਿਨ ਸ਼ੁੱਕਰਵਾਰ ਜਾਂ ਵੀਰਵਾਰ ਜਦੋਂ ਵੀ ਬੀਬੀਆਂ ਵਿਹਲੀਆਂ ਹੁੰਦੀਆਂ ਉਹ ਸਾਰੀਆਂ ਆ ਕੇ ਭਜਨ ਮੰਡਲੀ ਵੀ ਉੱਥੇ ਸ਼ਬਦ ਗਾਉਂਦੀਆਂ ਉਹ ਮੰਦਰ 'ਚ ਹੀ ਸ਼ਬਦ ਗਾਉਂਦੀਆਂ ਸਾਡੇ ਪਿੰਡ ਜ਼ਿਆਦਾਤਰ ਰਾਜਪੂਤ ਨੇ ਜਿਹਨਾਂ ਦਾ ਰੋਜ਼ ਕੋਈ ਨਾ ਕੋਈ ਸਤਿਸੰਗ ਹੁੰਦਾ ਹੈ ਅਤੇ ਉਹ ਰੋਜ਼ ਮਾਈਕ 'ਚ ਸ਼ਬਦ ਬੋਲਦੀਆਂ ਅਤੇ ਉਹ ਸਵੇਰੇ ਲੱਗਦੀਆਂ ਨੇ ਸ਼ਾਮ ਤੱਕ ਉਹਨਾਂ ਦੀ ਸਮਾਪਤੀ ਕਰਦੀਆਂ ਅਤੇ ਬਹੁਤ ਸੋਹਣੇ ਸ਼ਬਦ ਬੋਲਦੀਆਂ ਸਾਰੇ ਦਿਨ ਪਿੰਡ 'ਚ ਰੌਣਕ ਲਗਾਈ ਰੱਖਦੀਆਂ ਨੇ ਅਤੇ ਮੰਦਰ ਵਿੱਚ ਮੰਦਰ ਵਿੱਚ ਵੀ ਕਾਫੀ ਰੌਣਕਾਂ ਹੁੰਦੀਆਂ ਹੈ ਨਵੇਂ ਨਵੇਂ ਜਗਰਾਤੇ ਹੁੰਦੇ ਆ ਨਵੇਂ ਨਵੇਂ ਤਿਉਹਾਰ ਮਨਾਏ ਜਾਂਦੇ ਜਿੱਥੇ ਭਜਨ ਮੰਡਲੀ ਵੀ ਬੀਬੀਆਂ ਲੱਗੀਆਂ ਹੁੰਦੀਆਂ ਬੰਦੇ ਲੱਗੇ ਹੁੰਦੇ ਆ ਬੱਚੇ ਲੱਗੇ ਹੁੰਦੇ ਆ ਸਾਰੇ ਹੱਸਦੇ ਖੇਡਦੇ ਆ ਰਲ ਮਿਲ ਕੇ ਫੇਰ ਇਹ ਗਾਉਂਦੇ ਹੁੰਦੇ ਆ ਸਾਰੇ ਜਣੇ ਅਤੇ ਜੇ ਅਸੀਂ ਕਰੀਏ ਗੁਰਦੁਆਰੇ ਦੀ ਗੱਲ ਤਾਂ ਗੁਰਦੁਆਰੇ 'ਚ ਪ੍ਰਭਾਤ ਫੇਰੀਆਂ ਦੇ ਟਾਈਮ ਜਾਂ ਕਿਸੇ ਪਾਠ ਧਰਾਇਆ ਹੋਵੇ ਜਾਂ ਕੋਈ ਸ਼ੁਭ ਸ਼ੁਭ ਅਵਸਰ ਹੋਵੇ ਅਤੇ ਉਹਦੇ 'ਤੇ ਵੀ ਉਹਨਾਂ ਨੇ ਘਰ ਸਾਡੀ ਬੀਬੀਆਂ ਜਿਹੜੀਆਂ ਲੱਗੀਆਂ ਆ ਨਾ ਉਹ ਸ਼ਬਦ ਗਾਉਂਦੀਆਂ ਨੇ ਮਾਈਕ ਵਿੱਚ ਪਰ ਉੱਥੇ ਇੰਨਾਂ ਹੈ ਕਿ ਢੋਲਕੀ ਵੱਜਦੀ ਹੈ ਤਾੜੀਆਂ ਨਹੀਂ ਮਾਰਦੇ ਪਰ ਜਿਹੜਾ ਮੰਦਰ ਵਿੱਚ ਸਤਿਸੰਗ ਹੁੰਦਾ ਉਹਦੇ ਵਿੱਚ ਤਾੜੀਆਂ ਜੋਰਾਂ ਸ਼ੋਰਾਂ ਨਾਲ ਮਾਰਦੇ ਨੇ ਅਤੇ ਰੌਣਕ ਲਗਾਈ ਰੱਖਦੇ ਨੇ ਅਤੇ ਪਿੰਡ ਵਿੱਚ ਕਿੰਨੇ ਹੋਰ ਵੀ ਜਿਹੜੇ ਪਿਛਲੇ ਪਾਸੇ ਮੰਦਰ ਉਹਦੇ ਵਿੱਚ ਵੀ ਬਹੁਤ ਮਜ਼ਾ ਆਉਂਦਾ ਆ ਉੱਥੇ ਉਹਨਾਂ ਨੇ ਜਨਮਆਸ਼ਟਮੀ ਹੁੰਦੀ ਹੈ ਜਾਂ ਸ਼ਿਵ ਜੀ ਜੀ ਦਾ ਹੁੰਦਾ ਹੈ ਸ਼ਿਵਰਾਤਰੀ ਹੁੰਦੀ ਹੈ ਤਾਂ ਉੱਥੇ ਵੀ ਬਹੁਤ ਮਜ਼ਾ ਆਉਂਦਾ ਹੈ ਉਹ ਵੀ ਸਾਰੀ ਰਾਤ ਰਾਤੀ ਲੱਗਦੇ ਹੈ ਜਗਰਾਤਾ ਕਰਨ ਅਤੇ ਸਵੇਰੇ ਦੋ ਤਿੰਨ ਦਿਨ ਲੱਗਾ ਹੀ ਰਹਿੰਦਾ ਲੱਗਾ ਹੀ ਰਹਿੰਦਾ ਦੁਪਹਿਰੇ ਵੀ ਉਹਨਾਂ ਨੇ ਸ਼ਬਦ ਗਾਉਣੇ ਰਾਤੀ ਵੀ ਸ਼ਬਦ ਗਾਉਣੇ ਮਜ਼ਾ ਬੜਾ ਆਉਂਦਾ ਉਹਨਾਂ ਨੂੰ ਦੇਖ ਕੇ ਕਿ ਹਜੇ ਤੱਕ ਹਜੇ ਕੀ ਹੈ ਸੱਭਿਆਚਾਰ ਚੱਲਿਆ ਹੀ ਕਰਦਾ ਪੁਰਾਣੇ ਸਮੇਂ ਦੇ ਜਿਹੜੇ ਸਾਡੇ ਬਜ਼ੁਰਗਾਂ ਨੇ ਦੱਸਿਆ ਉਹ ਵੀ ਕਿੱਥੇ ਬੈਠਦੇ ਹਨ ਇਹਦਾ ਮਤਲਬ ਕਿ ਉਹ ਕਈ ਵਾਰੀ ਮੰਦਰ 'ਚ ਬੈਠਦੇ ਹਨ ਕਈ ਵਾਰੀ ਜੇ ਕਿਸੇ ਦੇ ਘਰ ਜਗਰਾਤੇ ਉੱਥੇ ਬੈਠਦੇ ਹਨ ਤਾਂ ਸਾਰੇ ਰਲ ਮਿਲ ਕੇ ਨਵੇਂ ਨਵੇਂ ਉਹਨਾਂ ਨੇ ਆਪਣੇ ਮ ਮੋਦਵਰ ਬੰਦੇ ਬਣਾਏ ਹੁੰਦੇ ਹਨ ਬੀਬੀਆਂ ਵੱਡੀਆਂ ਲੱਗੀਆਂ ਹੁੰਦੀਆਂ ਉਹਨਾਂ ਵਿੱਚ ਛੋਟੇ ਬੱਚੇ ਵੀ ਉਹਨਾਂ ਨੂੰ ਦੇਖ ਦੇਖ ਕੇ ਕੰਮ ਕਰਦੇ ਹਨ ਸੋ ਇਸੇ ਤਰ੍ਹਾਂ ਸਾਰੇ ਘੁਲ ਮਿਲ ਕੇ ਬਹੁਤ ਸੋਹਣੇ ਸ਼ਬਦ ਗਾਉਂਦੇ ਹਨ ਮਜ਼ਾ ਬੜਾ ਆਉਂਦਾ ਹੈ ਉਹਦੇ ਸ਼ਬਦ ਸੁਣ ਕੇ ਅਤੇ ਬਸ ਇੱਦਾਂ ਹੀ ਸਾਰਾ ਕੰਮ ਚੱਲੀ ਜਾਂਦਾ